ਯੂਟਿਊਬ ਦੇ ਮਸ਼ਹੂਰ ਚੈਨਲ ਹਨ ਡਾਂਸ ਵਾਲੇ ਡਾਂਸ ਫੂਲ ਡਾਂਸ ਟਰਾਈਵ ਟੀ ਵੀ ਡਾਂਸਰ ਹੱਬ ਡਾਂਸ ਪਾਰਟੀ ਹੱਬ ਅਤੇ ਲੋਕ ਨਾਚ ਦੇ ਮਸ਼ਹੂਰ ਚੈਨਲ ਹਨ ਪੰਜਾਬੀ ਫੋਕ ਡਾਂਸ ਮਲਵਈ ਗਿੱਧਾ ਭੰਗੜਾ ਲੁੱਡੀ ਸੰਮੀ ਅਤੇ ਪੰਜਾਬੀ ਫੋਕ ਡਾਂਸ ਭੰਗੜਾ ਲੁੱਡੀ ਸੰਮੀ ਹਰੇਕ ਕਾਲਜਾਂ ਵਿੱਚ ਸਿਖਾਇਆ ਅਤੇ ਕਰਵਾਇਆ ਜਾਂਦਾ ਹੈ ਅਤੇ ਇਸ ਨੂੰ ਥਾਂ ਥਾਂ ਵਿੱਚ ਇਹਦਾ ਇਸਦੇ ਵਿੱਚ ਹਰੇਕ ਚੀਜ਼ ਸਿਖਾਈ ਜਾਂਦੀ ਹੈ ਕਿ ਸਟੈਪ ਬਾਏ ਸਟੈਪ ਵੀ ਤੁਸੀਂ ਇਹ ਕਿਵੇਂ ਕਰਨਾ ਹੈ ਅਤੇ ਇਹਨਾਂ ਵਿੱਚ ਸਾਰੇ ਰੁਚੀ ਬਹੁਤ ਲੈਂਦੇ ਹਨ ਅਤੇ ਬੱਚਿਆਂ ਨੂੰ ਇਹ ਬਹੁਤ ਚੰਗੇ ਲੱਗਦੇ ਹਨ ਅਤੇ ਜਿਸ ਕਾਰਨ ਨੌਜਵਾਨ ਇਸ ਵਿੱਚ ਸੁਝਾਅ ਹੈ